ਹਾਂਜੀ ਵੀਰੇ ਕੌਣ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਵੀਰੇ ਵਿਕਾਸ ਇੰਪਰੂਵਮੈਂਟ ਬਹੁਤ ਹੈਗੀ ਆ ਵੀਰੇ ਇੱਥੇ ਆਊਟਲੈਟ ਬਣ ਰਹੇ ਆ ਸੜਕਾਂ ਬਣ ਰਹੀਆਂ ਨੇ ਬਸ ਆਪਾਂ ਨੂੰ ਬੱਸ ਸਟੈਂਡ ਨੂੰ ਥੋੜ੍ਹਾ ਸੁਧਾਰਨਾ ਚਾਹੀਦਾ ਕਿਉਂਕਿ ਉੱਥੇ ਟਰੈਵਲਸ ਕਰਨ ਮਤਲਬ ਕਿ ਵਿ ਵਿਜੀਟਰ ਉੱਥੇ ਹੀ ਆਉਂਦੇ ਪਹਿਲਾਂ ਠੀਕ ਹੈ ਨਾ ਆਪਾਂ ਨੂੰ ਬੱਸ ਸਟੈਂਡ ਸੁਧਾਰਨਾ ਚਾਹੀਦਾ ਪਹਿਲਾਂ ਤਾਂ ਰੋਡ ਵੀਰੇ ਹਾਂਜੀ ਹਾਂਜੀ ਰੋਡ ਠੀਕ ਆ ਜੀ ਮਤਲਬ ਕਿ ਮਲੋਟ ਰੋਡ ਪਹਿਲਾਂ ਨਹੀਂ ਬਣਿਆ ਸੀ ਹੁਣ ਬਹੁਤ ਜ਼ਿਆਦੇ ਵਧੀਆ ਬਣਾ ਤਾ ਅਤੇ ਆਪਣੇ ਕੋਲ ਜਲਾਲਾਬਾਦ ਵਾਲਾ ਪੁਲ ਵੀ ਬਣ ਚੁੱਕਿਆ ਨੇ ਅਤੇ ਹੁਣ ਆਪਣਾ ਰੇਲਵੇ ਸਟੇਸ਼ਨ ਬਣ ਰਿਹਾ ਬਹੁਤ ਜ਼ਿਆਦਾ ਡਵਲਪ ਹੋਈ ਜਾਂਦੀ ਆ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਕੰਮ ਹੋ ਰਿਹਾ ਮੁਕਤਸਰ 'ਚ ਇਹ ਆਊਟ ਕਿਹੜੇ ਮੇਰੇ ਵੀਰਾ ਹੋਸਪਿਟਲਸ ਬਾਈ ਬਹੁਤ ਵਧੀਆ ਨੇ ਵਧੀਆ ਮਤਲਬ ਕਿ ਡੋਕਟਰਸ ਨੇ ਬਹੁਤ ਜ਼ਿਆਦਾ ਆਪਣੇ ਮਤਲਬ ਕਿ ਇੱਕ ਊਸ਼ਾ ਗੁਪਤਾ ਹੋ ਗਿਆ ਅਤੇ ਇੱਕ ਦੁੱਗਲ ਬਹੁਤ ਮੁਕਤਸਰ ਦੇ ਮੰਨੇ ਤੰਨੇ ਡਾਕਟਰ ਨੇ ਇਹ ਹਾਂਜੀ ਵੀਰੇ ਅਤੇ ਹੁਣ ਹਾਂਜੀ ਹਾਂਜੀ ਬਹੁਤ ਛੇਤੀ ਹੋ ਜਾਂਦਾ ਹੁਣ ਤਾਂ ਪਹਿਲਾਂ ਮਤਲਬ ਕਿ ਜਦੋਂ ਸਰਕਾਰ ਨਹੀਂ ਆਈ ਸੀਗੀ ਅਤੇ ਉਦੋਂ ਬਹੁਤ ਜ਼ਿਆਦੇ ਵੇਟ ਕਰਨੀ ਪੈਂਦੀ ਸੀ ਹੁਣ ਜਿਹੜੀ ਸਰਕਾਰ ਨੇ ਆ ਕੇ ਜੋ ਸਕੀਮਾਂ ਖੋਲ੍ਹੀਆਂ ਨੇ ਬਹੁਤ ਜ਼ਿਆਦੀ ਛੇਤੀ ਕੰਮ ਕਰ ਦਿੰਦੀਆਂ ਨੇ ਹਾਂਜੀ ਵੀਰ ਮਤਲਬ ਕਿ ਪਹਿਲਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਵੀਰੇ ਮਤਲਬ ਕਿ ਟਾਈਮ ਟਾਈਮ 'ਤੇ ਇਹਨਾਂ ਦੀ ਪੈਨਸ਼ਨ ਆ ਰਹੀ ਆ ਵੀਰੇ ਪਹਿਲਾਂ ਲੇਟ ਹੋ ਜਾਂਦੀ ਸੀ ਹਾਂਜੀ ਬਿਲਕੁਲ ਹੀ ਟਾਈਮ 'ਤੇ ਆ ਰਹੀ ਆ ਅਤੇ ਵੀਰੇ ਮਤਲਬ ਕਿ ਬਹੁਤ ਵਿਕਾਸ ਹੋ ਰਿਹਾ ਹੁਣ ਇੱਕ ਆਊਟਲੈਟ ਬਣ ਗਿਆ ਕੋਟਪੂਰਾ ਰੋਡ 'ਤੇ ਕੋਟਪੂਰਾ ਰੋਡ 'ਤੇ ਇੱਕ ਹੋਰ ਆਊਟਲੈਟ ਬਣ ਰਿਹਾ ਬਹੁਤ ਸਿਨਮਾ ਘਰ ਸਿਨਮਾ ਘਰ ਤਾਂ ਇੱਕ ਹੀ ਆ ਅਤੇ ਬਹੁਤ ਵਧੀਆ ਚੱਲਦਾ ਆਪਾਂ ਨੂੰ ਮਤਲਬ ਕਿ ਇੱਕ ਹੋਰ ਸਿਨਮਾ ਘਰ ਹੋਣਾ ਚਾਹੀਦਾ ਸ਼ਹਿਰ ਦੇ ਵਿੱਚ ਹਾਂਜੀ ਕਿਉਂਕਿ ਇੱਕ ਸਿਨਮਾ ਘਰ ਨਾਲ ਨਹੀਂ ਸਰਦਾ ਅਤੇ ਦੂਜਾ ਵੀ ਹੋਣਾ ਚਾਹੀਦਾ ਇੱਕ 'ਚ ਜਾ ਜਾ ਕੇ ਹਰ ਇੱਕ ਬੰਦਾ ਬੋਰ ਹੁੰਦਾ ਹੀ ਹੁੰਦਾ ਹਾਂਜੀ ਹਾਂਜੀ ਕਮੀਆਂ ਮੈਂ ਦੱਸ ਰਿਹਾ ਜੀ ਸੀਵਰੇਜ ਦੀ ਕਮੀ ਠੀਕ ਹੈ ਜਦੋਂ ਮੀਂਹ ਆਉਂਦਾ ਸੀ ਮਤਲਬ ਕਿ ਪਾਣੀ ਸਾਰੇ ਕਿਤੇ ਖੜ੍ਹਿਆ ਰਹਿੰਦਾ ਅਤੇ ਬਸ ਸਟੈਂਡ 'ਤੇ ਬਹੁਤ ਜ਼ਿਆਦੇ ਬੁਰਾ ਹਾਲ ਹੋ ਜਾਂਦਾ ਜੀ ਇਸ ਕਰਕੇ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਕਿ ਬੱਸ ਸਟੈਂਡ ਕੋਲ ਸੀ ਸੀਵਰੇਜ ਦਾ ਕੰਮ ਕਰੇ ਅਤੇ ਬਸ ਸਟੈਂਡ ਦੀ ਥੋੜ੍ਹੀ ਹਾਲਤ ਸੁਧਾਰੇ ਬਹੁਤ ਜ਼ਿਆਦੇ ਵਧੀਆ ਬੱਸ ਸਟੈਂਡ ਹੁੰਦਾ ਸੀ ਜੋ ਕਿ ਹੁਣ ਬਹੁਤ ਜ਼ਿਆਦੇ ਖਰਾਬ ਹੋਇਆ ਪਿਆ ਠੀਕ ਹੈ ਅਤੇ ਬੱਸ ਸਟੈਂਡ ਵਾਲੀ ਸੜਕ ਪੂਰੀ ਰਿਪੇਅਰ ਕਰਾਈ ਜਾਵੇ ਸਰਕਾਰ ਵੱਲੋਂ ਹਾਂਜੀ ਮੇਰੀ ਤਾਂ ਆਹੀ ਬੇਨਤੀ ਹੈ ਹਾਂਜੀ ਵੀਰੇ ਹਾਂਜੀ ਵੀਰੇ ਠੀਕ ਹੈ ਵੀਰੇ ਠੀਕ ਹੈ ਜੀ ਧੰਨਵਾਦ ਜੀ